ਹਾਂਜੀ ਮੈਂ ਇੱਕ ਐਡੀਡਾਸ ਦੇ ਬੂਟ ਮੰਗਵਾਏ ਸੀ ਉਹ ਮੈਨੂੰ ਬਹੁਤ ਵਧੀਆ ਲੱਗਦੇ ਹਨ ਅਤੇ ਮੇਰੇ ਯਾਰਾਂ ਦੋਸਤਾਂ ਨੂੰ ਵੀ ਬਹੁਤ ਵਧੀਆ ਲੱਗਦੇ ਹਨ ਅਤੇ ਮੈਨੂੰ ਪਾਉਣ ਵਿੱਚ ਵੀ ਬਹੁਤ ਸੌਖੇ ਲੱਗਦੇ ਹਨ